ਮੈਂ ਇੱਕ ਆਨਲਾਈਨ ਗੇਮਿੰਗ ਕਨਸੋਲ ਦਾ ਆਰਡਰ ਦਿੱਤਾ ਇਹ ਗੇਮ ਪਲੇ ਅਤੇ ਡੂੰਘੇ ਗਰਾਫਿਕਸ ਤੋਂ ਮੈਂ ਬਹੁਤ ਖੁਸ਼ ਹਾਂ ਇਸ ਗੇਮ ਗੇਮ ਦੇ ਕਨਸੋਲ ਰਾਹੀਂ ਮੇਰੇ ਬੱਚੇ ਬਹੁਤ ਸੋਹਣੇ ਤਰੀਕੇ ਨਾਲ ਖੇਡਦੇ ਹਨ ਇਸ ਦੇ ਗਰਾਫਿਕਸ ਬਹੁਤ ਵਧੀਆ ਹਨ ਅਤੇ ਡੂੰਘੇ ਹਨ ਇਸ ਦੇ ਨਾਲ ਦਿਮਾਗੀ ਕਸਰਤ ਵੀ ਬਹੁਤ ਵਧੀਆ ਹੁੰਦੀ ਹੈ ਮੇਰਾ ਅਨੁਭਵ ਇਸ ਆਨਲਾਈਨ ਸਟੋਰ ਦੇ ਨਾਲ ਬਹੁਤ ਵਧੀਆ ਰਿਹਾ ਹੈ ਇਹਨਾਂ ਨੇ ਮੈਨੂੰ ਇਸ ਗੇਮਿੰਗ ਕਨਸੋਲ ਦੀ ਇੱਕ ਸਾਲ ਦੀ ਗਰੰਟੀ ਵੀ ਦਿੱਤੀ ਹੈ ਇਸ ਗਰੰਟੀ ਅਧੀਨ ਜੇ ਵੀ ਕੋਈ ਨੁਕਸ ਪੈਦਾ ਹੋਇਆ ਤਾਂ ਇਹ ਤੁਰੰਤ ਇਸਦੀ ਵਾਪਸੀ ਕਰ ਲੈਣਗੇ ਇਸ ਕਰਕੇ ਮੈਂ ਬਿਲਕੁਲ ਸੰਤੁਸ਼ਟ ਹਾਂ ਮੈਨੂੰ ਇਸ ਗੇਮਿੰਗ ਕਨਸੋਲ ਨੇ ਬਹੁਤ ਵਧੀਆ ਢੰਗ ਦੇ ਨਾਲ ਮੇਰੇ ਬੱਚਿਆਂ ਲਈ ਖੁਸ਼ੀ ਪ੍ਰਦਾਨ ਕਰਨ ਦਾ ਇੱਕ ਬਹੁਤ ਵਧੀਆ ਮੌਕਾ ਉਪਲੱਬਧ ਕਰਵਾਇਆ ਹੈ ਮੈਨੂੰ ਇਸ ਲਈ ਬਹੁਤ ਵਧੀਆ ਇਹ ਗੇਮਿੰਗ ਕਨਸੋਲ ਲੱਗਿਆ ਕਿਉਂਕਿ ਇਹ ਬੈਟਰੀ ਰਾਹੀਂ ਵੀ ਚੱਲਦਾ ਹੈ ਜਦੋਂ ਬਿਜਲੀ ਨਹੀਂ ਹੁੰਦੀ ਤਾਂ ਸਾਨੂੰ ਇਹਦੀ ਕੋਈ ਸਮੱਸਿਆ ਨਹੀਂ ਆਉਂਦੀ ਬੱਚੇ ਨਿਰਵਿਘਨ ਹੋ ਕੇ ਇਸ ਗੇਮਿੰਗ ਕਨਸੋਲ ਨੂੰ ਖੇਡਦੇ ਹਨ ਮੈਨੂੰ ਬਹੁਤ ਖੁਸ਼ੀ ਹੈ ਇਸ ਆਨਲਾਈਨਿੰਗ ਗੇਮ ਕਨਸੋਲ ਮੈਂ ਬਾਰ ਬਾਰ ਖਰੀਦਾਂ ਮੈਂ ਬਾਕੀ ਸਾਰਿਆਂ ਨੂੰ ਵੀ ਇਹ ਹੀ ਰਾਏ ਦਿੰਦੀ ਹਾਂ ਕਿ ਇਸ ਗੇਮਿੰਗ ਕਨਸੋਲ ਦੇ ਰਾਹੀਂ ਤੁਸੀਂ ਨਿਸ਼ਚਿੰਤ ਹੋ ਕੇ ਆਪਣੇ ਬੱਚਿਆਂ ਨੂੰ ਖੇਡਾਂ ਖਿਡਾ ਸਕਦੇ ਹੋ ਧੰਨਵਾਦ ਜੀ